ਸਤਿ ਸ਼੍ਰੀ ਅਕਾਲ ਜੀ ਅਮਨ ਬੀਜ ਭੰਡਾਰ ਤੋਂ ਬੋਲਦੇ ਜੀ ਤੁਸੀਂ ਮੈਂ ਜੀ ਗੈਰੀ ਭਾਗੀ ਤੋਂ ਬੋਲਦਾ ਸੀਗਾ ਜੀ ਮੈਂ ਇੱਕ ਉਹ ਪੁੱਛਣਾ ਸੀਗਾ ਜੀ ਅਸੀਂ ਨਾ ਮੂੰਗੀ ਬੀਜੀ ਆ ਜੀ ਐਤਕੀ ਥੋੜ੍ਹਾ ਜਿਹਾ ਅਸੀਂ ਖਾਦ ਬਾਰੇ ਅਤੇ ਉਹਦੀ ਸਪਰੇਅ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਜੀ ਅਤੇ ਖਰੀਦਣੀ ਵੀ ਹੈਗੀ ਹੈ ਜੀ ਮੈਂ ਮੂੰਗੀ ਬੀਜੀ ਜੀ ਉਹਦੇ ਵਾਸਤੇ ਰੇਹਾਂ ਸਪਰੇਹਾਂ ਥੋੜ੍ਹੀਆਂ ਦੱਸੋ ਮੈਨੂੰ ਦੋ ਕੁ ਮਹੀਨੇ ਦੀ ਹੋ ਗਈ ਜੀ ਬਸ ਇਸ ਤੋਂ ਪਹਿਲਾਂ ਖਾਦ ਨਹੀਂ ਇਸ ਤੋਂ ਪਹਿਲਾਂ ਇੱਕ ਵਾਰੀ ਸਪਰੇਅ ਕੀਤੀ ਸੀਗੀ ਜੀ ਹਾਂਜੀ ਥੋੜ੍ਹਾ ਜਿਹਾ ਉਹਦੇ ਵਿੱਚ ਆਏਂ ਆ ਜੀ ਐਂ ਜੇ ਲੱਗ ਰਿਹਾ ਜੀ ਮਤਲਬ ਥੋੜ੍ਹੀ ਮੁਰਝਾ ਜੇ ਰਹੀ ਹੈ ਜੀ ਥੋੜ੍ਹਾ ਜਿਹਾ ਇਸ ਕਰਕੇ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਉਹਨੂੰ ਖਾਦ ਜਾਂ ਕੋਈ ਪੈਸਟੀਸਾਈਡ ਵਗੈਰਾ ਦੀ ਲੋੜ ਪੈਣੀ ਆ ਉਹਨੂੰ ਅਤੇ ਨਵੀਂ ਉਹਦੇ 'ਚ ਆਈ ਹੈ ਜੀ ਸੈਵਨ ਪੋਆਇੰਟ ਫਾਈਵ ਆਈ ਹੈ ਜੀ ਉਹਦੀ ਨਵੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਪੱਤੇ ਪੀਲੇ ਪੈ ਰਹੇ ਜੀ ਹਾਂਜੀ ਹਾਂਜੀ ਪੱਤੇ ਪੀਲੇ ਪੈ ਰਹੇ ਥੋੜ੍ਹੇ ਥੋੜ੍ਹੇ ਹਾਂਜੀ ਹਾਂ ਹਾਂਜੀ

ਅੱਛਾ ਅੱਛਾ ਜੀ ਠੀਕ ਹੈ ਜੀ ਅਤੇ ਇਹਦੇ ਥੋੜ੍ਹਾ ਬਹੁਤਾ ਇਹਦਾ ਖਰਚੇ ਦਾ ਐਸਟੀਮੇਟ ਮੰਨ ਲਉ ਮਾੜਾ ਮੋਟਾ ਅੰਦਾਜਾ ਕਿਹੜੇ ਹਿਸਾਬ ਨਾਲ ਲੱਗਣਗੇ ਮਤਲਬ ਦੋ ਕੁ ਕਿੱਲੇ ਬੀਜੇ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਸਰ ਠੀਕ ਹੈ ਜੀ ਨਾ ਮੈਂ ਵਿਜਿਟ ਕਰੂੰਗਾ ਜੀ ਕਦੋਂ ਵਿਜਿਟ ਕਰਾਂ ਤੁਹਾਡੇ ਕੋਲ ਮੈਂ ਠੀਕ ਹੈ ਜੀ ਮਿਹਰਬਾਨੀ ਸਰ ਮਿਹਰਬਾਨੀ